ਪੈਰੀਂ ਪੈਂਦਾ ਕੋਚ ਸਾਹਿਬ ਵਧੀਆ ਵਧੀਆ ਜੀ ਤੁਸੀਂ ਦੱਸੋ ਕਿਵੇਂ ਜੀ ਹੋਰ ਘਰ ਪਰਿਵਾਰ ਠੀਕ ਹੈ ਜੀ ਤੁਹਾਡਾ ਪੈਰ ਜਿਹਾ ਦੁਖਦਾ ਜੀ ਕਿਵੇਂ ਠੀਕ ਹੈ ਹੁਣ ਜੀ ਠੀਕ ਹੈ ਜੀ ਅੱਛਾ ਜੀ ਠੀਕ ਹੈ ਅਤੇ ਮੈਂ ਤਾਂ ਆਏਂ ਪੁੱਛਦਾ ਸੀਗਾ ਜੀ ਵੀ ਹੁਣ ਮੂਹਰੇ ਭਰਤੀ ਆਈ ਜਾਂਦੀ ਆਰਮੀ ਦੀ ਮੈਂ ਸੋਲਾਂ ਸੌ ਮੀਟਰ ਦੀ ਤਿਆਰੀ ਕਰਦਾ ਜੀ ਤੁਸੀਂ ਮਾੜਾ ਮੋਟਾ ਜੀ ਦੇ ਦਿੰਦੇ ਜੀ ਫਾਰਮ ਭਰੇ ਸੀ ਹਾਂਜੀ ਭਰਤੇ ਉਹ ਤਾਂ ਜੀ ਭਰਤੇ ਮਾੜਾ ਮੋਟਾ ਕੋਈ ਦੱਸ ਦਿੰਦੇ ਜੀ ਟਰੇਨਿੰਗ ਕਿਵੇਂ ਕਰਾਂ ਨਾਲੇ ਜੀ ਵਰਕਆਊਟ ਪੇਪਰ 'ਚੋ ਪਾਸ ਹਾਂ ਹਾਂਜੀ ਰੱਬ ਤੁਹਾਨੂੰ ਵੀ ਵਧਾਵੇ ਜੀ ਠੀਕ ਹੈ ਜੀ ਕਿਵੇਂ ਜੀ ਵਰਕਆਊਟ ਮਾੜਾ ਜਿਹਾ ਦੱਸ ਦਿਓ ਹੁਣ ਜੀ ਸੋਲਾਂ ਸੌ ਮੀਟਰ ਦੀ ਕਰਨੀ ਹੈ ਜੀ ਸੋਲਾਂ ਸੌ ਮੀਟਰ ਦੀ

ਠੀਕ ਹੈ ਜੀ ਠੀਕ ਹੈ ਜੀ ਭਰਤੀ ਹਾਲੇ ਦੂਰ ਹੀ ਹੈ ਜੀ ਠੀਕ ਹੈ ਜੀ ਹਾਂਜੀ ਇਹ ਤਾਂ ਗੱਲ ਹੈਗੀ ਏ ਜੀ ਅਤੇ ਡਾਇਟ ਵਗੈਰਾ ਪਲੈਨ ਜੀ

ਠੀਕ ਹੈ ਜੀ ਠੀਕ ਹੈ ਜੀ ਹੋਰ ਮੂੰਗੀ ਕਿਹੜੀ ਜੀ ਅੱਛਾ ਉਹ ਜੀ ਉਹ ਵੀ ਆਏਂ ਕਰਦੇ ਹੁੰਦੇ ਆ ਜੀ ਠੀਕ ਹੈ ਜੀ ਮੈਂ ਕਹਿੰਦਾ ਦਾਲ ਤਾਂ ਨਹੀਂ ਬਣਾਉਣੀ ਜੀ ਠੀਕ ਹੈ ਜੀ ਠੀਕ ਹੈ ਜੀ ਗਰਾਉਂਡ 'ਚ ਕੀ ਕੀ ਲੈ ਕੇ ਆਵਾਂ ਜੀ ਇੱਕ ਪਾਣੀ ਦੀ ਬੋਤਲ ਹੈ ਨਾ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਫਿੱਟ ਹੀ ਹੈ ਜੀ ਬਸ ਤੁਹਾਡੀ ਕਿਰਪਾ ਹੈ ਠੀਕ ਹੈ ਚਲੋ ਫਿਰ ਕੱਲ੍ਹ ਮਿਲਦੇ ਏ ਸ਼ਾਮ ਨੂੰ